ਰੂਪਨਗਰ ਜ਼ਿਲ੍ਹੇ ਵਿੱਚ ਰੋਜ਼ਗਾਰ ਦਾ ਮੁੱਖ ਸਾਧਨ ਖੇਤੀਬਾੜੀ ਹਨ ਇੱਥੋਂ ਦੇ ਲੋਕ ਨੌਕਰੀਆਂ ਵੀ ਕਰਦੇ ਹਨ ਫੈਕਟਰੀਆਂ ਵਿੱਚ ਵੀ ਲੱਗੇ ਹੋਏ ਹਨ ਫ਼ੌਜ ਵਿੱਚ ਵੀ ਭਰਤੀ ਹਨ ਅਤੇ ਪੁਲਿਸ ਵਿੱਚ ਵੀ ਹਨ ਅਤੇ ਬਹੁਤੇ ਲੋਕ ਮਜ਼ਦੂਰੀ ਵੀ ਕਰਦੇ ਹਨ ਅੱਜ ਦੇ ਟੈਮ ਵਿੱਚ ਲੋਕ ਪ੍ਰਾਈਵੇਟ ਨੌਕਰੀਆਂ ਨਾਲੋਂ ਸਰਕਾਰੀ ਨੌਕਰੀਆਂ ਨੂੰ ਜ਼ਿਆਦਾ ਮਾਨਤਾ ਦਿੰਦੇ ਹਨ ਕਿਉਂਕਿ ਪ੍ਰਾਈਵੇਟ ਨੌਕਰੀਆਂ ਨਾਲੋਂ ਸਰਕਾਰੀ ਨੌਕਰੀਆਂ ਦੀ ਆਮਦਨ ਬਹੁਤ ਹੀ ਜ਼ਿਆਦਾ ਹਨ ਅਤੇ ਸਾਨੂੰ ਸਿਹਤ ਬ ਸਬੰਧੀ ਬਹੁਤ ਜ਼ਿਆਦਾ ਸਹੂਲਤਾਂ ਮਿਲਦੀਆਂ ਹਨ ਸਿਹਤ ਸਬੰਧੀ ਸਹੂਲਤਾਂ ਮਿਲਦੀਆਂ ਹਨ ਅਤੇ ਸਾਨੂੰ ਨੌਕਰੀ ਨੌਕਰੀ ਵਿੱਚ ਰਿਟਾਇਰ ਹੋਣ ਤੋਂ ਬਾਅਦ ਵੀ ਪੈਨਸ਼ਨ ਲੱਗਦੀ ਹਨ ਰੂਪਨਗਰ ਜ਼ਿਲ੍ਹੇ ਦੇ ਸਾਰੇ ਲੋਕ ਕੰਮ ਕਿਸੇ ਨਾ ਕਿਸੇ ਕੰਮ ਧੰਦੇ ਵਿੱਚ ਲੱਗੇ ਹੋਏ ਹਨ ਮਤਲਬ ਕਿ ਰੂਪਨਗਰ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਅੱਜ ਦੇ ਟਾਈਮ ਵਿੱਚ ਵਿਹਲਾ ਨਹੀਂ ਹਨ ਸ ਕੋਈ ਅ ਕੋਈ ਨਾ ਕੋਈ ਆਪਣਾ ਧੰਦਾ ਖੇਤੀਬਾੜੀ ਜਾਂ ਫਿਰ ਆਪਣਾ ਬਿਜ਼ਨਸ ਕਰਦੇ ਹਨ ਜਿਵੇਂ ਕਿ ਮੈਂ ਰੂਪਨਗਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅਤੇ ਮੈਂ ਵੀ ਇੱਕ ਨਰਸਿੰਗ ਸਟੂਡੈਂਟ ਹਾਂ ਮੈਂ ਵੀ ਫਿਊਚਰ ਹੈਲਥ ਵਰਕਰ ਬਣਨਾ ਚਾਹੁੰਦੀ ਹਾਂ ਅਤੇ ਸਟਾਫ ਨਰਸ ਤਾਂ ਜੋ ਮੈਂ ਲੋਕਾਂ ਦੀ ਦੇਖਭਾਲ ਕਰ ਸਕਾਂ